ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਵਿੱਦਿਅਕ ਅਦਾਰੇ ਹਨ ਜਿਵੇਂ ਕਿ ਖੇਤੀਬਾੜੀ ਯੂਨੀਵਰਸਿਟੀ ਕਾਲਜ ਬੱਲੋਂਆਲ ਸੌਂਖੜੀ ਐੱਮ ਆਰ ਸਿਟੀ ਪਬਲਿਕ ਸਕੂਲ ਬਲਾਚੌਰ ਅਤੇ ਮਾਊਂਟ ਕਾਰਮਲ ਸਕੂਲ ਬਲਾਚੌਰ ਇਸੇ ਤਰ੍ਹਾਂ ਸਰਕਾਰੀ ਆਈ ਟੀ ਆਈ ਨਵਾਂ ਸ਼ਹਿਰ ਅਤੇ ਸ਼ਿਵਾਲਿਕ ਸਕੂਲ ਨਵਾਂ ਸ਼ਹਿਰ ਕੈਮਰੇਜ ਸਕੂਲ ਨਵਾਂ ਸ਼ਹਿਰ ਅਤੇ ਬਹੁਤ ਸਾਰੇ ਏ ਸਕੂਲ ਅਤੇ ਯੂਨੀਵਰਸਿਟੀਆਂ ਹਨ ਜਿੱਥੇ ਵਿਦਿਆਰਥੀ ਬਹੁਤ ਲਾਭ ਉਠਾਉਂਦੇ ਹਨ ਪਰ ਫੀਸਾਂ ਥੋੜ੍ਹੀ ਜਿਹੀਆਂ ਜ਼ਿਆਦਾ ਹੋਣ ਕਰਕੇ ਕੁਛ ਵਿਦਿਆਰਥੀ ਵਾਂਝੇ ਰਹਿ ਜਾਂਦੇ ਹਨ ਜੇਕਰ ਫੀਸਾਂ ਨੂੰ ਘਟਾਇਆ ਜਾਵੇ ਤਾਂ ਹੋਰ ਵੀ ਵਿਦਿਆਰਥੀ ਜਿਹੜੇ ਹੈ ਉਹ ਲਾਭ ਲੈ ਸਕਦੇ ਹਨ ਅਤੇ ਬਾਕੀ ਰਹਿਤ ਬਹਾਰਾ ਵੀ ਹੈਗਾ ਇੱਥੇ ਅਤੇ ਹੋਰ ਵੀ ਹੈਗੇ ਹੈ ਜੇਕਰ ਫੀਸਾਂ ਦਾ ਥੋੜ੍ਹਾ ਕੰਟਰੋਲ ਹੋ ਜਾਵੇ ਤਾਂ ਵੱਧ ਤੋਂ ਵੱਧ ਵਿਦਿਆਰਥੀ ਜਿਹੜਾ ਆ ਉਹ ਲਾਭ ਉਠਾ ਸਕਦੇ ਹਨ